ਭਾਰਤ ਵਿੱਚ ਬਹੁਤ ਮੌਸਮ ਹਨ ਜਿਵੇਂ ਗਰਮੀ ਸਰਦੀ ਪਤਝੜ ਹੈ ਜਿਨ੍ਹਾਂ ਵਿੱਚੋਂ ਵੱਖ ਵੱਖ ਸਟੇਟਾਂ ਵਿੱਚ ਵੱਖ ਵੱਖ ਮੌਸਮ ਹੁੰਦੇ ਹਨ ਜਿਵੇਂ ਕਿ ਹਿਮਾਚਲ ਵਿੱਚ ਸਦਾ ਹੀ ਮੌਸਮ ਠੰਡਾ ਰਹਿੰਦਾ ਹੈ ਅਤੇ ਜ਼ਿਆਦਾਤਰ ਲੋਕ ਗਰਮੀਆਂ ਵਿੱਚ ਸ਼ਿਮਲੇ ਜਾਂਦੇ ਹਨ ਜਿਨ੍ਹਾਂ ਕਾਰਨ ਉਹਨਾਂ ਦੇ ਮਨ ਨੂੰ ਸ਼ਾਂਤੀ ਅਤੇ ਠੰਡਾ ਮਾਹੌਲ ਹੁੰਦਾ ਹੈ ਜਿਵੇਂ ਕਿ ਸਾਰੇ ਭਾਰਤ ਵਿੱਚ ਗਰਮੀ ਪੈਂਦੀ ਹੈ ਅਤ ਪਰ ਸ਼ਿਮਲੇ ਵਿੱਚ ਮੌਸਮ ਠੰਡਾ ਹੈ ਅਤੇ ਇੱਦਾਂ ਹੀ ਅਲੱਗ ਅਲੱਗ ਸਟੇਟਾਂ ਵਿੱਚ ਅਲੱਗ ਅਲੱਗ ਮੌਸਮ ਹੁੰਦੇ ਹਨ ਅਤੇ ਕੁਛ ਸਟੇਟਾਂ ਤਮਿਲਨਾਡੂ ਜਿਨ੍ਹਾਂ ਵਿੱਚ ਸਰਦੀਆਂ ਦੇ ਟਾਈਮ 'ਤੇ ਵੀ ਬਹੁਤ ਸਾ ਜ਼ਿਆਦਾ ਗਰਮੀ ਪੈਂਦੀ ਹੈ